ਹੈਲੋ ਤੁਸੀਂ ਮੀਸ਼ੋ ਤੋਂ ਬੋਲ ਰਹੇ ਜੇ ਮੈਂ ਨਾ ਮੀਸ਼ੋ ਤੋਂ ਦੋ ਬੂਟਾਂ ਦੇ ਜੋੜੇ ਆਡਰ ਕੀਤੇ ਸੀ ਇੱਕ ਤਾਂ ਜੋੜਾ ਮੇਰੇ ਕੋਲ ਸਹੀ ਆ ਗਿਆ ਅਤੇ ਦੂਜਾ ਜੋੜਾ ਜਿਹੜਾ ਹੈ ਉਹ ਖ਼ਰਾਬ ਆਇਆ ਜਿਹੜਾ ਆਰਡਰ ਸੀ ਉਹ ਤਾਂ ਟਾਈਮ ਸਿਰ ਮੇਰੇ ਕੋਲ ਪਹੁੰਚ ਗਿਆ ਹੈ ਪਰ ਜਿਹੜਾ ਦੂਜਾ ਬੂਟਾ ਦਾ ਜੋੜਾ ਸੀ ਨਾ ਉਹਦੀ ਕੰਪਨੀ ਵੀ ਹੋਰ ਆਈ ਆ ਅਤੇ ਉਹਦੇ ਜਿਹੜੇ ਰੰਗ ਆ ਉਹ ਵੀ ਹੋਰ ਆਇਆ ਵਾ ਅਤੇ ਜਿਹੜਾ ਸਾਈਜ਼ ਆ ਉਹ ਵੀ ਵੱਡਾ ਵਾ ਅਤੇ ਉਹ ਬੂਟ ਮੇਰੇ ਕਿਸੇ ਕੰਮ ਨਹੀਂ ਆਏ ਉਹ ਬੂਟ ਜਿਹੜੇ ਆ ਉਹ ਉੱਪਰੋਂ ਵੀ ਬਹੁਤ ਖ਼ਰਾਬ ਜਿਹੇ ਹੋਏ ਆ ਅਤੇ ਇਸ ਕਰਕੇ ਮੈਂ ਤੁਹਾਨੂੰ ਸ਼ਿਕਾਇਤ ਕਰਦੀ ਹਾਂ ਕਿ ਮੇਰੇ ਜਿਹੜੇ ਬੂਟ ਆ ਜਾਂ ਤਾਂ ਉਹਨਾਂ ਦੀ ਬਦਲੀ ਕੀਤੀ ਜਾਵੇ ਬਦਲ ਕੇ ਜਿਹੜਾ ਮੈਂ ਆਡਰ ਕੀਤਾ ਸੀ ਉਹ ਭੇਜਿਆ ਜਾਵੇ ਅਤੇ ਜਾਂ ਫਿਰ ਮੇਰੇ ਪੈਸੇ ਵਾਪਸ ਕੀਤੇ ਜਾਣ ਅਤੇ ਮਾੜੇ ਔਡਰ ਦੇਣ 'ਤੇ ਤੁਹਾਡੇ ਕਾਰੋਬਾਰ 'ਤੇ ਜਿਹੜਾ ਵਾ ਮਾੜਾ ਪ੍ਰਭਾਵ ਪਵੇਗਾ ਕੱਲ੍ਹ ਨੂੰ ਮੈਂ ਲੋਕਾਂ ਨੂੰ ਵੀ ਦੱਸੂੰਗੀ ਕਿ ਉੱਥੋਂ ਜਿਹੜੇ ਆ ਉਹ ਆਡਰ ਨਾ ਕਰੋ ਕਿਉਂਕਿ ਉੱਥੋਂ ਚੀਜ਼ ਜਿਹੜੀ ਆ ਉਹ ਖ਼ਰਾਬ ਆਈ ਆ ਅਤੇ ਜੇ ਤੁਸੀਂ ਚੰਗਾ ਸਮਾਨ ਭੇਜੋਗੇ ਤਾਂ ਮੈਂ ਲੋਕਾਂ ਨੂੰ ਵੀ ਦੱਸੂੰਗੀ ਕਿ ਤੁਸੀਂ ਉੱਥੋਂ ਆਡਰ ਕਰੋ ਅਤੇ ਉੱਥੋਂ ਬਹੁਤ ਵਧੀਆ ਸਮਾਨ ਮਿਲਦਾ ਵਾ ਅਤੇ ਇਹ ਆਡਰ ਤੋਂ ਤਾਂ ਮੈਂ ਤੁਹਾਡੇ ਤੋਂ ਬਹੁਤ ਜ਼ਿਆਦਾ ਨਿਰਾਸ਼ ਹੋਈ ਹਾਂ ਇਸ ਕਰਕੇ ਮੈਨੂੰ ਚੰਗਾ ਆਡਰ ਭੇਜੋ ਅਤੇ ਅੱਗੇ ਤੋਂ ਜਿਹੜਾ ਵਾ ਉਹ ਬਿਲਕੁਲ ਸਹੀ ਆਡਰ ਆਵੇ ਜਿਹੜਾ ਅਸੀਂ ਆਡਰ ਕੀਤਾ ਹੋਵੇ ਅਤੇ ਇਸ ਕਰਕੇ ਹੁਣ ਜਾਂ ਤਾਂ ਮੇਰੇ ਬੂਟਾਂ ਦੀ ਬਦਲੀ ਕੀਤੀ ਜਾਵੇ ਅਤੇ ਜਾਂ ਫਿਰ ਮੈਨੂੰ ਪੈਸੇ ਵਾਪਸ ਕੀਤੇ ਜਾਣ